ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਟੂਰਿਸਟ ਗਾਈਡ ਬੋਲ ਰਿਹਾ ਜੀ ਮੈਂ ਕਿੰਨੇ ਪਰਸਨ ਹੋ ਜੀ ਤੁਸੀਂ ਅੱਛਾ ਦੋ ਜਾਣੇ ਹੋ ਕਪਲ ਹੋ ਤੁਸੀਂ ਠੀਕ ਹੈ ਜੀ ਕਿੰਨੇ ਦਿਨਾਂ ਲਈ ਹੋ ਤੁਸੀਂ ਇੱਥੇ ਅੱਛਾ ਚਾਰ ਦਿਨਾਂ ਲਈ ਹੋ ਤੁਸੀਂ ਠੀਕ ਹੈ ਜੀ ਕੋਈ ਗੱਲ ਨਹੀਂ ਜੀ ਤੁਸੀਂ ਬਣਾ ਸਕਦੇ ਹੋ ਰਾਬਤਾ ਸਾਡੇ ਨਾਲ ਡਾਇਰੈਕਟ ਵੀ ਅਤੇ ਜਗ੍ਹਾ ਤੁਹਾਨੂੰ ਬਠਿੰਡੇ ਦੀਆਂ ਦਿਖਾ ਦਾਂਗੇ ਅਸੀਂ ਅਤੇ ਇਹਦੇ ਵਿੱਚ ਇਹ ਹੋਊਗਾ ਵੀ ਉੱਕੀ ਪੁੱਕੀ ਫੀਸ ਹੁੰਦੀ ਹੈ ਸਾਡੀ ਬਾਕੀ ਖਾਣ ਪੀਣ ਜਿਹੜਾ ਉਹਦੇ 'ਚ ਤੁਹਾਡਾ ਹੋਊਗਾ ਅਤੇ ਇਹਦੇ ਵਿੱਚ ਮੇਨ ਤਾਂ ਤੁਹਾਨੂੰ ਬਠਿੰਡੇ ਦੀ ਜਗ੍ਹਾ ਦੇ ਵਿੱਚ ਅਸੀਂ ਜਿਹੜਾ ਦਿਖਾ ਸਕਦੇ ਉਹ ਕਿਲ੍ਹਾ ਮੁਬਾਰਕ ਹੈ ਅਤੇ ਕਿਲ੍ਹਾ ਮੁਬਾਰਕ ਤੋਂ ਬਾਅਦ ਤੁਹਾਨੂੰ ਚੇਤਕ ਪਾਰਕ ਲੈ ਕੇ ਜਾ ਸਕਦੇ ਹੈ ਉੱਥੇ ਵੀ ਤੁਸੀਂ ਉਸ ਨੂੰ ਵੇਖ ਸਕਦੇ ਅਤੇ ਬਾਕੀ ਤੁਸੀਂ ਕੋਈ ਖਰੀਦਦਾਰੀ ਕਰਨੀ ਹੋਈ ਕੋਈ ਫਿਲਮ ਵਗੈਰਾ ਮੂਵੀ ਵਗੈਰਾ ਦੇਖਣੀ ਟਾਈਮ ਸਪੈਂਡ ਕਰਨਾ ਤਾਂ ਮਿੱਤਲ ਸਿਟੀ ਮੋਲ ਵੀ ਹੈ ਉੱਥੇ ਜਾ ਸਕਦੇ ਹੋ ਰਿਲਾਈਨਸ ਮੌਲ ਵਗੈਰਾ ਵੀ ਤੁਸੀਂ ਜਾ ਸਕਦੇ ਹੋ ਅਤੇ ਹਾਜੀ ਰਤਨ ਗੁਰਦੁਆਰਾ ਸਾਹਿਬ ਵੀ ਹੈ ਅਤੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਨਾਲ ਹੀ ਬਠਿੰਡੇ ਦੇ ਪੈ ਜਾਂਦਾ ਉਹ ਵੀ ਉੱਥੇ ਵੀ ਲਿਜਾ ਸਕਦੇ ਹਾਂ ਤੁਹਾਨੂੰ ਅਤੇ ਬਠਿੰਡੇ ਦੇ ਵਿੱਚ ਹੀ ਰੋਜ਼ ਗਾਰਡਨ ਆ ਉਹ ਵੀ ਦਿਖਾ ਸਕਦੇ ਹਾਂ ਜੀ ਅਤੇ ਨਾਲ ਹੀ ਪਿੰਡ ਹੈ ਜੀ ਬਠਿੰਡੇ ਦੇ ਉੱਥੇ ਚਿੜੀਆਂ ਘਰ ਆ ਜਿਹੜਾ ਉੱਥੇ ਚਿੜੀਆਂ ਘਰ ਦੇ ਵਿੱਚ ਤੁਹਾਨੂੰ ਲਿਜਾ ਸਕਦੇ ਹੈ ਨਾ ਅਤੇ ਇਹਦੇ ਵਿੱਚ ਜਿਹੜੀਆਂ ਜਿਹੜੀਆਂ ਤੁਹਾਡੀਆਂ ਚੋਆਇਸਸ ਰਹਿਣਗੀਆਂ ਉਹ ਵੇਖ ਲਿਓ ਤੁਸੀਂ ਫਨ ਫਨ ਵਾਲਾ ਵੀ ਆ ਵਾਟਰ ਪਾਰਕ ਦਾ ਵੀ ਅੋਪਸ਼ਨ ਹੈ ਤੁਹਾਡੇ ਕੋਲ ਅਤੇ ਉਹ ਜਗ੍ਹਾ ਦੇ ਹਿਸਾਬ ਨਾਲ ਵੀ ਹੋਊਗਾ ਰੂਟ ਦੇ ਹਿਸਾਬ ਨਾਲ ਅਸੀਂ ਤੁਹਾਨੂੰ ਫਿਰ ਉਹਦਾ ਚਾਰਜ ਆ ਜਿਹੜਾ ਵੱਖਰਾ ਵੱਖਰਾ ਰਹੂਗਾ ਅਤੇ ਹਾਂਜੀ ਝੀਲਾਂ ਵ ਝੀਲਾਂ ਵਗੈਰਾ ਦਾ ਸਾਰੇ ਮਤਲਬ ਜਗ੍ਹਾ ਦਾ ਅੱਡ ਅੱਡ ਹਿਸਾਬ ਨਾਲ ਆ ਜਿਹੜਾ ਉਹਦਾ ਰਹੂਗਾ ਖਾਣ ਪੀਣ ਤੁਹਾਡਾ ਆਪਣਾ ਹੋਊਗਾ ਸਾਡੀ ਉੱਕੀ ਪੁੱਕੀ ਇਹਦੇ 'ਚ ਫੀਸ ਹੋਊਗੀ ਅਸੀਂ ਤੁਹਾਨੂੰ ਗੱਡੀ ਦੇ ਉੱਤੇ ਲੈ ਜਾਵਾਂਗੇ ਏ ਸੀ ਗੱਡੀ ਹੋਊਗੀ ਸਵਿਫਟ ਡਿਜ਼ਾਇਰ ਤੇ ਹਾਂਜੀ

ਹਾਂ ਦੁਬਾਰਾ ਤੁਸੀਂ ਕੋਲ ਕਰ ਲਿਓ ਜਦੋਂ ਵੀ ਜਿਵੇਂ ਹੋਇਆ ਤੁਹਾਡਾ ਇੱਕ ਮਾੜਾ ਜਿਹਾ ਤੁਸੀਂ ਵੀ ਜਗ੍ਹਾ ਸਲੈਕਟ ਕਰ ਲਿਓ ਅਸੀਂ ਵੀ ਆਪਣੇ ਹਿਸਾਬ ਨਾਲ ਤੁਹਾਨੂੰ ਦਿਖਾ ਦੇਵਾਂਗੇ ਓਕੇ ਜੀ ਓਕੇ ਓਕੇ ਮਿਹਰਬਾਨੀ ਜੀ